ਹੈਲੋ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਜਲੰਧਰ ਤੋਂ ਗੱਲ ਕਰ ਰਹੇ ਆਂ ਹਾਂਜੀ ਬਿਲਕੁਲ ਮੈਂ ਕਾਊਸਲਿੰਗ ਡਿਪਾਰਟਮੈਂਟ ਤੋਂ ਗੱਲ ਕਰ ਰਹੀ ਹ ਮੈਮ ਹਾਂਜੀ ਅੱਛਾ ਜੀ ਮਤਲਬ ਤੁਹਾਨੂੰ ਤੁਹਾਡੇ ਘਰ ਦੇ ਠੀਕ ਹ ਮੈਮ ਦੇਖੋ ਅੱਜ ਕੱਲ ਦਾ ਜਿਹੜਾ ਸਾਡਾ ਵਾਤਾਵਰਨ ਜਿਹਦੇ ਵਿੱਚ ਅਸੀਂ ਰਹਿ ਰਹੇ ਆਂ ਚਾਹੇ ਅਸੀਂ ਆਪਣੇ ਘਰ ਦੀ ਗੱਲ ਕਰੀਏ ਜਾਂ ਅਸੀਂ ਆਪਣੀ ਨੌਕਰੀ ਪੇਸ਼ੇ ਦੀ ਗੱਲ ਕਰੀਏ ਹਰ ਜਗਹਾ ਈ ਨਾ ਇੱਕ ਟੈਂਸ਼ਨ ਦਾ ਸਟਰੈਸ ਦਾ ਮਾਹੌਲ ਜਿਹਾ ਬਣਿਆ ਰਹਿੰਦਾ ਹਾਂਜੀ ਉਹ ਇਸ ਕਰਕੇ ਕਿਉਂਕਿ ਲੋਕੀ ਨਾ ਪੈਸੇ ਦੇ ਪਿੱਛੇ ਬਹੁਤ ਦੌੜਦੇ ਆ ਲੋਕਾਂ ਨੂੰ ਜਿਹੜੀ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚੋਂ ਮਨੋਰੰਜਨ ਨੂੰ ਬਿਲਕੁਲ ਹੀ ਬਾਹਰ ਕੱਢ ਦਿੱਤਾ ਜਿਹਦੇ ਕਰਕੇ ਉਹਨਾਂ ਦੇ ਦਿਮਾਗੀ ਦਿਮਾਗੀ ਸੰਤੁਲਨ ਆ ਜਿਹੜਾ ਉਹ ਬਿਲਕੁਲ ਹੀ ਖਰਾਬ ਹੁੰਦਾ ਜਾਂਦਾ ਜਦੋਂ ਉਹ ਪੂਰੇ ਦਾ ਪੂਰਾ ਧਿਆਨ ਉਹਨਾਂ ਦਾ ਕਿਤਾਬਾਂ ਵਿੱਚ ਟੀ ਵੀ ਤੇ ਕੰਪਿਊਟਰਾਂ ਤੇ ਲੱਗਿਆ ਰਹਿੰਦਾ ਇਹਦੇ ਨਾਲ ਉਹਨੂੰ ਸਿਹਤ ਦੀ ਸਮੱਸਿਆਵਾਂ ਵੈਸੇ ਹੀ ਹੁੰਦੀਆਂ ਨੇ ਤੇ ਜਿਹੜੀ ਉਹਨਾਂ ਦੀ ਮੈਂਟਲ ਹੈਲਥ ਦੀ ਆਪਾਂ ਕਹਿੰਦੇ ਆ ਦਿਮਾਗੀ ਸੰਤੁਲਨ ਉਹ ਵੀ ਵਿਗੜ ਜਾਂਦਾ ਤੇ ਇਸੇ ਕਰਕੇ ਜਿਹੜੀ ਇਹ ਕਾਉਂਸਲਿੰਗ ਦੀ ਇੱਕ ਨਵੀਂ ਇੱਕ ਕਹਿ ਦੋ ਤੁਸੀਂ ਬਿਜ਼ਨਸ ਮਾਰਕੀਟ ਵਿੱਚ ਆ ਗਿਆ ਵੈ ਪਹਿਲਾਂ ਥੋੜੀ ਕਾਉਂਸਲਿੰਗ ਕਿਸੇ ਦੀ ਹੋਇਆ ਕਰਦੀ ਸੀਗੀ ਪਹਿਲਾਂ ਤੇ ਲੋਕੀ ਆਪਣੇ ਚ ਈ ਮਸਤ ਹੁੰਦੇ ਸੀ ਪਰਿਵਾਰਾਂ ਨਾਲ ਮਿਲ ਜੁਲ ਕੇ ਰਹਿੰਦੇ ਸੀਗੇ ਬਾਹਰ ਜਿਹੜੀ ਕੁਦਰਤ ਹੈਗੀ ਉਹਦੇ ਨਾਲ ਬਹਿੰਦੇ ਸੀਗੇ ਗੱਲਾਂ ਬਾਤਾਂ ਕਰਦੇ ਸੀਗੇ ਇੱਕ ਦੂਜੇ ਨਾਲ ਖੇਡਦੇ ਕੁਦਦੇ ਸੀ ਅੱਜ ਕੱਲ ਤਾਂ ਛੋਟੇ ਛੋਟੇ ਬੱਚਿਆਂ ਨੂੰ ਹੀ ਇਹ ਕਾਉਂਸਲਿੰਗ ਦੀ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਜਿਹਦੇ ਚ ਅੱਛਾ ਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਮੈਮ ਮੈਂ ਤੁਹਾਨੂੰ ਸਲਾਹ ਦੇਣਾ ਚਾਹਵਾਂਗੀ ਅੱਜਕੱਲ ਜਿਹੜੀਆਂ ਪ੍ਰਾਈਵੇਟ ਨੌਕਰੀ ਨੇ ਨਾ ਉਹਨਾਂ ਦਾ ਸਮਾਂ ਬਹੁਤ ਹੀ ਲੰਬਾ ਹੋ ਗਿਆ ਹੋਇਆ ਤੇ ਜਿਹੜੇ ਪ੍ਰਾਈਵੇਟ ਸਾਡੇ ਕੋਲ ਨੌਕਰੀਆਂ ਲੈ ਵੀ ਰਹੇ ਨੇ ਨਾ ਜਿਹੜੇ ਇੰਮਪਲੋਇਰ ਉਥੇ ਬੈਠੇ ਨੇ ਉਹ ਮਤਲਬ ਇੱਕ ਤਰ੍ਹਾਂ ਨਾਲ ਬੰਦੇ ਦਾ ਖੂਨ ਈ ਕੱਢ ਲੈਂਦੇ ਨੇ ਬਿਲਕੁਲ ਤੇ ਆਪਾਂ ਸਲਾਹ ਇਹੀ ਦਿੰਨੇ ਆ ਜਿਹੜਾ ਵੀ ਬੰਦਾ ਪ੍ਰਾਈਵੇਟ ਨੌਕਰੀਆਂ ਕਰਦਾ ਪਿਆ ਕਿ ਉਹ ਆਪਣੀ ਨੌਕਰੀ ਵਿੱਚ ਆਪਣੇ ਆਪ ਲਈ ਟਾਈਮ ਜਰੂਰ ਕੱਢੇ ਸਾਨੂੰ ਜਦੋਂ ਵੀ ਵਿਹਲ ਮਿਲੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਆਪਣੀ ਰੁਚੀਆਂ ਨੂੰ ਰੁਚਿਆਂ ਵੱਲ ਜਾਓ ਜੇ ਤੁਹਾਨੂੰ ਗਾਣੇ ਸੁਣਨਾ ਪਸੰਦ ਤੁਸੀਂ ਗਾਣੇ ਸੁਣਿਆ ਕਰੋ ਤੇ ਤੁਹਾਨੂੰ ਕੁਦਰਤ ਨਾਲ ਰਹਿਣਾ ਪਸੰਦ ਆ ਤੁਸੀਂ ਪਾਰਕ ਵਿੱਚ ਜਾ ਕੇ ਸੈਰ ਕਰ ਲਈ ਇਹੋ ਜਿਹੀ ਐਕਟੀਵਿਟੀ ਉਥੇ ਵੀ ਕਰਦੇ ਰਿਹਾ ਕਰੋ ਤਾਂ ਕਿ ਤੁਹਾਨੂੰ ਇਹ ਮਹਿਸੂਸ ਨਾ ਹੋਵੇ ਕਿ ਪਤਾ ਨਹੀਂ ਮੈਂ ਕਿਹੜੇ ਜੰਗਲ ਵਿੱਚ ਬੀਆਬਾਨ ਚ ਆ ਗਿਆ ਵਾਂ ਕਿ ਮੈਨੂੰ ਇੱਥੇ ਕੁਝ ਮਨੋਰੰਜਨ ਲਈ ਕੁਛ ਮਿਲਦਾ ਹੀ ਨਹੀਂ ਪਿਆ ਹਾਂਜੀ ਕਾਉਂਸਲਿੰਗ ਸੈਸ਼ਨ ਸਾਡਾ ਸ਼ਾਮ ਦੇ ਟਾਈਮ ਰੋਜ਼ ਹੁੰਦਾ ਔਰ ਜਿਹੜੀ ਤੁਸੀਂ ਪੁੱਛ ਰਹੇ ਹੋ ਕਿ ਇਹਦੀ ਮਤਲਬ ਆਪਾਂ ਸ਼ਾਮ ਦੇ ਟਾਈਮ ਰੋਜ਼ ਕਰਨੇ ਆ ਤੁਸੀਂ ਜਦੋਂ ਵੀ ਚਾਹੋ ਲੈ ਸਕਦੇ ਆ ਕੋਈ ਇਹ ਨਿਰਭਰ ਕਰਦਾ ਕਿ ਬੰਦਾ ਕਿੰਨੀ ਜਲਦੀ ਸਾਡੇ ਨਾਲ ਖੁੱਲ ਜਾਂਦਾ ਜਿਸ ਵੇਲੇ ਬਹੁਤ ਜਲਦੀ ਖੁੱਲ ਜਾਂਦਾ ਉਹਨੂੰ ਆਪਾਂ ਜਲਦੀ ਅਟੈਂਡ ਕਰ ਪਾਦੇ ਆ ਜਦੋਂ ਤੱਕ ਬੰਦਾ ਸਾਡੀ ਗੱਲ ਦਾ ਜਵਾਬ ਹੀ ਨਹੀਂ ਦੇਗਾ ਉਹਨਾਂ ਟਾਈਮ ਉਹ ਜਿਆਦਾ ਲੈ ਜਾਂਦਾ ਹਾਂਜੀ ਹਾਂਜੀ ਬਿਲਕੁਲ ਮੈਮ ਬਿਲਕੁਲ ਤੁਸੀਂ ਜਰੂਰ ਆਓ ਆਪਾਂ ਤੁਹਾਡੀ ਪੂਰੀ ਪੂਰੀ ਸੇਵਾ ਕਰਾਂਗੇ ਬਿਲਕੁਲ ਹੈਲਪ ਕਰਾਂਗੇ ਓਕੇ ਸਤਿ ਸ੍ਰੀ ਅਕਾਲ ਮੈਮ